ਹਾਂਜੀ ਸਿਹਤ ਸੰਭਾਲ ਦੇ ਖੇਤਰ ਦੀ ਲੋੜ ਹਰੇਕ ਤਰ੍ਹਾਂ ਦੇ ਲੋਕ ਨੂੰ ਹੁੰਦੀ ਹੈ ਉਹ ਚਾਹੇ ਪਿੰਡ ਦੇ ਕਸਬਿਆਂ ਦੇ ਜਾਂ ਸ਼ਹਿਰਾਂ ਦੇ ਵਸਨੀਕ ਹੋਣ ਕਿਉਂਕਿ ਸਿਹਤ ਸੁਵਿਧਾ ਪ੍ਰਾਪਤ ਕਰਨ ਦਾ ਹੱਕ ਹਰ ਇੱਕ ਨੂੰ ਹੈ ਹਾਂਜੀ ਇਹ ਸੁਵਿਧਾਵਾਂ ਹਰ ਇੱਕ ਖੇਤਰ ਵਿੱਚ ਵੱਖ ਵੱਖ ਪੱਧਰ ਦੀਆਂ ਹੁੰਦੀਆਂ ਹਨ ਭਾਵ ਪਿੰਡਾਂ ਵਿੱਚ ਛੋਟੀਆਂ ਛੋਟੀਆਂ ਡਿਸਪੈਂਸਰੀਆਂ ਹੁੰਦੀਆਂ ਹਨ ਜਿੱਥੇ ਕਿ ਮਰੀਜ਼ ਨੂੰ ਛੋਟੀ ਮੋਟੀ ਦਵਾਈ ਹੀ ਮਿਲ ਸਕਦੀ ਹੈ ਪਰ ਗੰਭੀਰ ਰੋਗ ਲਈ ਮਰੀਜ਼ ਨੂੰ ਸ਼ਹਿਰ ਵੱਲ ਹੀ ਆਉਣਾ ਪੈਂਦਾ ਹੈ ਐਮਰਜੰਸੀ ਇਲਾਜ ਦੀ ਸੁਵਿਧਾ ਵੱਡੇ ਕਸਬਿਆਂ ਅਤੇ ਪਿੰਡਾਂ ਵਿੱਚ ਪ੍ਰਾਪਤ ਨਹੀਂ ਹੁੰਦੀ ਇਸ ਦੇ ਉਲਟ ਸ਼ਹਿਰਾਂ ਵਿੱਚ ਇਲਾਜ ਲਈ ਵੱਡੇ ਵੱਡੇ ਹਸਪਤਾਲ ਕਲੀਨਿਕ ਆਦਿ ਉਪਲਬਧ ਹੁੰਦੇ ਹਨ ਕਿਉਂਕਿ ਸ਼ਹਿਰਾਂ ਵਿੱਚ ਆਵਾਜਾਈ ਦੇ ਸਾਧਨ ਹੋਣ ਕਰਕੇ ਲੋਕ ਉੱਥੇ ਸੌਖੇ ਹੀ ਪਹੁੰਚ ਸਕਦੇ ਹਨ ਸ਼ਹਿਰਾਂ ਵਿੱਚ ਹਰੇਕ ਰੋਗ ਨਾਲ ਸੰਬੰਧਿਤ ਮਾਹਰ ਡਾਕਟਰ ਕਲੀਨਿਕ ਜਾਂ ਹਸਪਤਾਲਾਂ ਵਿੱਚ ਮਿਲ ਜਾਂਦੇ ਹਨ ਇਸ ਕਰਕੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਸਿਹਤ ਸਹੂਲਤਾਂ ਵਿੱਚ ਕਾਫੀ ਭਿੰਨਤਾ ਹੈ